ਸਰ ਮੇਰਾ ਨਾਮ ਭਾਰਤ ਭੂਸ਼ਨ ਪਿੰਡ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਤੇ ਜੇਕਰ ਗੱਲ ਕਰੀਏ ਯੂ ਐਫ ਓ ਦੀ ਤਾਂ ਇੱਕ ਦਿਨ ਤਾਂ ਮੈਂ ਦੇਖਦਾ ਪਿਆ ਸੀ ਆਸਮਾਨ ਵੱਲ ਰਾਤ ਨੂੰ ਸੁੱਤਾ ਪਿਆ ਸੀ ਅਤੇ ਦੇਖਦੇ ਦੇਖਦੇ ਇੱਕ ਚਮਕਦੀ ਹੋਈ ਚੀਜ਼ ਮੈਨੂੰ ਨਜ਼ਰ ਆਈ ਅਤੇ ਅਚਾਨਕ ਹੀ ਗਾਇਬ ਹੋ ਗਈ ਸ਼ਾਇਦ ਹੋ ਸਕਦਾ ਕਿ ਯੂ ਐਫ ਏ ਹੀ ਹੋਵੇ ਅਤੇ ਅਤੇ ਇਸ ਤਰ੍ਹਾਂ ਦੇ ਅਕ ਇੱਕ ਵਾਰ ਹੀ ਮੈਂ ਇਸ ਚੀਜ਼ ਨੂੰ ਦੇਖ ਸਕਿਆ ਬਾ ਦੂਸਰੇ ਤੀਸਰੇ ਦਿਨ ਮੈਂ ਕੋਸ਼ਿਸ਼ ਕੀਤੀ ਸ਼ਾਇਦ ਇਸੇ ਟਾਈਮ 'ਤੇ ਰੋਜ਼ ਹੀ ਦਿਸਦੀ ਹੋਏ ਪਰ ਇਹ ਦਿਸੀ ਨਹੀਂ ਮੁਜ ਮੈਨੂੰ ਅਤੇ ਜੇਕਰ ਗੱਲ ਕਰੀਏ ਦੂਸਰੇ ਗ੍ਰਹਿਵਾਂ ਦੇ ਰਹਿਣ ਬਾਰੇ ਅਤੇ ਉੱਥੇ ਰਿਸਰਚ ਚੱਲਦੀ ਪਈ ਆ ਹਜੇ ਕਈ ਗ੍ਰਹਿਵਾਂ ਦੇ ਉੱਤੇ ਪਾਣੀ ਦੀ ਰਿਸਰਚ ਚੱਲਦੀ ਪਈ ਆ ਕਈ ਗ੍ਰਹਿਵਾਂ ਦੇ ਉੱਤੇ ਆਕਸੀਜਨ ਦੀ ਰਿਸਰਚ ਚਲਦੀ ਪਈ ਆ ਅਤੇ ਸੰਭਵ ਹੋ ਸਕਦਾ ਹੈ ਕੁਝ ਸਮੇਂ ਬਾਅਦ ਸਾਡਾ ਉੱਥੇ ਰਹਿਣਾ ਸੰਭਵ ਹੋ ਜਾਵੇ ਅਤੇ ਅਤੇ ਜਿੱਦਾਂ ਕਿ ਕਾਫੀ ਗ੍ਰਹਿ ਹੈ ਇਹੋ ਜਿਹੇ ਵੀ ਆ ਜਿਹੜੇ ਬਹੁਤ ਜ਼ਿਆਦਾ ਠੰਡੇ ਹੈ ਅਤੇ ਕਈ ਬਹੁਤ ਜ ਜ਼ਿਆਦਾ ਗਰਮ ਹੈ ਅਤੇ ਕਾਫੀ ਜਗ੍ਹਾ 'ਤੇ ਰਿਸਰਚ ਦੇ ਵਿੱਚ ਪਤਾ ਲੱਗਿਆ ਕਿ ਪਾਣੀ ਦੀ ਉੱਥੇ ਹੈ ਅ ਉੱਥੇ ਪਾਣੀ ਮੌਜੂਦ ਆ ਅਤੇ ਹੋ ਸਕਦਾ ਕੁਛ ਸਮੇਂ ਬਾਅਦ ਇਨਸਾਨ ਦਾ ਉੱਥੇ ਰਹਿਣਾ ਸੰਭਵ ਹੋ ਜਾਵੇ ਧੰਨਵਾਦ ਜੀ